ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰੀਤ ਟੈਲੀਕੋਮ ਬਠਿੰਡਾ ਤੋਂ ਬੋਲ ਰਹੇ ਹੋ ਜੀ ਹਾਂਜੀ ਮੈਂ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਪ੍ਰੋਡਕਟ ਲਏ ਆ ਸੈਮਸੰਗ ਦੇ ਅਤੇ ਕਾਫ਼ੀ ਸਾਰੇ ਮੈਂ ਤੁਹਾਡੇ ਤੋਂ ਮਤਲਬ ਜਿਹੜੇ ਹੈ ਪ੍ਰੋਡਕਟ ਲਿਆਉਂਦਾ ਰਹਿੰਦਾ ਹੈਗਾ ਤਾਂ ਪਿਛ ਪਹਿਲਾਂ ਕੋਈ ਕਾਫ਼ੀ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਈ ਮੈਨੂੰ ਤਾਂ ਮਤਲਬ ਇਸ ਵਾਰ ਸਮੱਸਿਆ ਇਹ ਆਈ ਕਿ ਮੈਨੂੰ ਮੇਰੇ ਬਹੁਤ ਸਾਰੇ ਦੋਸਤਾਂ ਨੇ ਕਈ ਵਾਰ ਕਿਹਾ ਸੀ ਵੀ ਇਸ ਦੁਕਾਨ ਤੋਂ ਕੋਈ ਪ੍ਰੋਡਕਟ ਨਾ ਲੈ ਸੈਮਸੰਗ ਦੇ ਮੋਬਾਈਲ ਦੀ ਲੋੜ ਸੀ ਮੈਨੂੰ ਤਾਂ ਮੈਂ ਤੁਹਾਡੇ ਤੋਂ ਲੈ ਲਿਆ ਪਰ ਉਹਦਾ ਅਲਟੀਮੇਟ ਨੁਕਸਾਨ ਇਹ ਹੋਇਆ ਕਿ ਇਸ ਵਾਰੀ ਨਾ ਮੇਰਾ ਉਹ ਪ੍ਰੋਡਕਟ ਬਿਲਕੁਲ ਬੇਕਾਰ ਨਿਕਲਿਆ ਉਹਦੀ ਬਹੁਤ ਜ਼ਿਆਦਾ ਕੰਪਲੇਂਟ ਸੀ ਬਹੁਤ ਜ਼ਿਆਦਾ ਉਹਦੀ ਸਮੱਸਿਆ ਸੀ ਮੈਂ ਤੁਹਾਨੂੰ ਕਈ ਵਾਰ ਅਪਰੋਚ ਕਰ ਚੁੱਕਿਆ ਪਰ ਤੁਹਾਡੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਮੇਰੇ ਦੋਸਤਾਂ ਦੀ ਗੱਲ ਹੈ ਜਿਹੜੀ ਉਹ ਸ ਇਸ ਵਾਰ ਸੱਚੀ ਸਾਬਿਤ ਹੋ ਰਹੀ ਲੱਗਦੀ ਹੈਗੀ ਹੈ ਅਤੇ ਜੇ ਤੁਸੀਂ ਮੇਰੇ ਇਸ ਗੱਲ ਨੂੰ ਪ੍ਰੋਬਲਮ ਨੂੰ ਨਹੀਂ ਸੁਣਦੇ ਤਾਂ ਮੇਰੀ ਮਜ਼ਬੂਰੀ ਹੋਵੇਗੀ ਕਿ ਮੈਂ ਇਹ ਪ੍ਰੋਬਲਮ ਤੁਹਾਡੀ ਜਿਹੜੀ ਰੇਟਿੰਗ ਆ ਉਹ ਵੀ ਨੈਗਟਿਵ ਕਰਾਂ ਅਤੇ ਤੁਹਾਡੀ ਪ੍ਰੋਬਲਮ ਜਿਹੜੀ ਇਹ ਮੇਰੀ ਤੁਸੀਂ ਪ੍ਰੋਬਲਮ ਹੈ ਜਿਹੜੀ ਤੁਸੀਂ ਨਹੀਂ ਸੁਣ ਰਹੇ ਮੈਂ ਇਹ ਆਮ ਲੋਕਾਂ ਤੱਕ ਵੀ ਲੈ ਕੇ ਜਾਵਾਂ ਅਤੇ ਮੈਂ ਲੋਕਾਂ ਨੂੰ ਦੱਸਾਂ ਕਿ ਜਿਹੜਾ ਪ੍ਰੀਤ ਟੈਲੀਕੋਮ ਬਠਿੰਡਾ ਹੈਗਾ ਉਸ ਦੇ ਉੱਤੇ ਇਹ ਤੁਸੀਂ ਮਤਲਬ ਜਿਹੜੇ ਹੈ ਤੁਹਾਡੀ ਡੀਲਿੰਗ ਠੀਕ ਨਹੀਂ ਹੈਗੀ ਤੁਸੀਂ ਗ੍ਰਾਹਕਾਂ ਨੂੰ ਮਿਸਗਾਈਡ ਕਰਕੇ ਅਤੇ ਲੋ ਮਤਲਬ ਜਿਹੜਾ ਹੋਰ ਗਲਤ ਤਰੀਕੇ ਨਾਲ ਜੋ ਜੋੜਦੇ ਹੋ ਅਤੇ ਤੁਹਾਡਾ ਜਿਹੜਾ ਪ੍ਰੋਡਕਟ ਆ ਉਹ ਸਹੀ ਨਹੀਂ ਹੈ ਅਤੇ ਮੈਂ ਉਮੀਦ ਕਰਦਾ ਤੁਸੀਂ ਮੇ ਇਸ ਮੇਰੀ ਗੱਲ ਨੂੰ ਧਿਆਨ ਨਾਲ ਸੁਣੋਗੇ ਅਤੇ ਨਹੀਂ ਤਾਂ ਮੈਨੂੰ ਮੇਰੀ ਮਜ਼ਬੂਰੀ ਹੋਵੇਗੀ ਕਿ ਮੈਂ ਲੋਕਾਂ ਦੇ ਵਿੱਚ ਤੁਹਾਡੇ ਇਹ ਨੈਗਟਿਵ ਜਿਹੜੀ ਗੱਲ ਆ ਉਹ ਲੈ ਕੇ ਜਾਵਾਂ ਜਿਹੜੇ ਤੁਸੀਂ ਮੈਨੂੰ ਇਹ ਪ੍ਰੋਡਕਟ ਚੇਂਜ ਕਰ ਦਿਓ ਅਤੇ ਨਹੀਂ ਮੇਰੀ ਇਹ ਜਿਹੜੀ ਹੈ ਸਮੱਸਿਆ ਦਾ ਹੱਲ ਕਰੋ ਓਕੇ